ਸਿਹਤ ਸੰਭਾਲ ਦਿਲ ਨੂੰ ਬਹੁਤ ਤਰ੍ਹਾਂ ਨਾਲ ਫੰਡ ਦਿੱਤੇ ਜਾਂਦੇ ਹਨ ਸਾਗਰਾ ਵੱਲੋਂ ਦਿੱਤੇ ਇਹ ਜਾਂਦੇ ਹਨ ਤੇ ਇਹ ਫੰਡ ਸਿਹਤ ਸੰਭਾਲ ਖੇਤਰ ਵਿੱਚ ਸੁਧਾਰ ਕਰਨ ਲਈ ਦਿੱਤੇ ਜਾਂਦੇ ਹਨ ਤੇ ਇਹ ਫੰਡ ਸਿਹਤ ਸੇਵਾਵਾਂ ਨੂੰ ਵਧਾਉਣ ਨੂੰ ਦਿੱਤੇ ਜਾਂਦੇ ਹਨ ਸਿਹਤ ਸੇਵਾਵਾਂ ਜੇ ਜਿਵੇਂ ਹਸਪਤਾਲ ਮੈਡੀਕਲ ਵਗੈਰਾ ਇਹ ਸੇਵਾਵਾਂ ਰਾਹੀਂ ਔਰਤਾਂ ਬੱਚਿਆਂ ਦੀ ਸਿਹਤ ਲਈ ਸਹਾਇਤਾ ਦਿੱਤੀ ਜਾਂਦੀ ਹੈ ਇਹ ਇਸ ਤਰ੍ਹਾਂ ਇਹ ਸੁਧਾਰ ਹਰ ਤਰ੍ਹਾਂ ਦੇ ਮਦਦਗਾਰ ਹੁੰਦਾ ਹੈ ਇਹ ਫੰਡ ਸਰਕਾਰ ਦੁਆਰਾ ਅਨਾਥ ਆਸ਼ਰਮ ਵਿੱਚ ਬੱਚਿਆਂ ਦੀ ਸਿਹਤ ਦੇ ਧਿਆਨ ਲਈ ਰੱਖਣ ਲਈ ਦਿੱਤਾ ਜਾਂਦਾ ਹੈ ਜਿਸ ਗਰੀਬ ਦੇ ਲੋ ਜਿਸ ਤਰਾਂ ਦੇ ਗਰੀਬ ਲੋਕਾਂ ਨੂੰ ਸਿਹਤ ਬਾਰੇ ਜਿਆਦਾ ਨਹੀਂ ਪਤਾ ਹੁੰਦਾ ਤਾਂ ਉਸ ਤਰਾਂ ਉਹਨਾਂ ਲਈ ਸਰਕਾਰ ਨਹੀਂ ਪਤਾ ਹੁੰਦਾ ਉਹਨਾਂ ਲਈ ਸਰਕਾਰ ਵੱਖ ਵੱਖ ਥਾਵਾਂ 'ਤੇ ਕੈਂਪ ਲਗਾਉਂਦੀ ਹੈ ਤੇ ਸਰਕਾਰ ਗਰੀਬਾਂ ਨੂੰ ਮਦਦ ਮੁਫਤ ਦਵਾਈਆਂ ਦਿੰਦੀਆਂ ਹਨ ਜੋ ਲੋਕਾਂ ਨੂੰ ਜਿਆਦਾ ਪ੍ਰਕਾਰ ਨਹੀਂ ਹੁੰਦੇ ਖਰਚ ਨਹੀਂ ਹੁੰਦੇ ਦੇ ਸਕਦੇ ਤੇ ਸਰਕਾਰ ਉਹਨਾਂ ਲਈ ਸਿਹਤ ਸਕੀਮ ਬਣਾਈ ਕਾਰਡ ਦੇ ਵਿੱਚ ਜਿਸ ਰਾਹੀ ਕੋਈ ਵੀ ਵਿਅਕਤੀ ਦਾ ਇਲਾਜ ਪੰਜ ਲੱਖ ਤੱਕ ਦਾ ਮੁਫਤ ਹੋ ਜਾਂਦਾ ਹੈ ਇਸ ਕਾਰਡ ਵਿੱਚ ਅੱਗੇ ਵਿੱਚੋਂ ਪੈਸੇ ਸਰਕਾਰ ਦੁਆਰਾ ਦਿੱਤੇ ਜਾਂਦੇ ਹਨ ਇਸ ਤਰ੍ਹਾਂ ਸਰਕਾਰ ਲੋਕਾਂ ਲਈ ਵੱਖ ਵੱਖ ਜਗ੍ਹਾ 'ਤੇ ਕੈਂਪ ਲਗਾ ਲਗਾਏ ਮੁਫਤ ਜਾ ਜਾਂਦੇ ਹਨ ਇਲਾਜ ਕ ਕਰਦੇ ਹੈ ਕਈ ਵਾਰ ਟੈਸਟ ਮੁਫਤ ਤੇ ਘੱਟ ਰਿਟਨ ਤੇ ਕਰਦੀ ਹੈ ਅਤੇ ਸਰਕਾਰ ਸਿਹਤ ਸੰਭਾਲ ਵਿੱਚ ਸੋਤ ਦੇ ਯੋਗਦਾਨ ਨੂੰ ਪਾਉਂਦੀ ਹੈ ਜਿਸ